ਹੈਲੋ ਹੈਲੋ ਸੁਨੀਤਾ ਕਿਵੇਂ ਆ ਹਾਂ ਮੈਂ ਵਧੀਆ ਹੋਰ ਘਰ ਬਾਰ ਕਿਵੇਂ ਹਾਂ ਮੈਂ ਵਧੀਆ ਹਾਂ ਸਭ ਵਧੀਆ ਹੋਰ ਬੱਚੇ ਕਿਵੇਂ ਨੇ ਅੱਛਾ ਨਵੀ ਕੀ ਕਰਦਾ ਹੁੰਦਾ ਅੱਜ ਕੱਲ੍ਹ ਅੱਛਾ ਕਿਹੜੀ ਕਲਾਸ 'ਚ ਹੋ ਗਿਆ ਇਹ ਵੈਸੇ ਅੱਛਾ ਤੁਸੀਂ ਵੀ ਉੱਥੇ ਮੁਕਤਸਰ ਹੀ ਰਹਿੰਦੇ ਹੋ ਕਿ ਇੱਧਰ ਆ ਗਏ ਆਪਣੇ ਪਿੰਡ ਅੱਛਾ ਅੱਛਾ ਅੱਛਾ ਯਾਰ ਅਸੀਂ ਵੀ ਨਾ ਉੱਥੇ ਮੈਂ ਵੀ ਆਪਣੇ ਨਾ ਬੇਟੇ ਨੂੰ ਮੁਕਤਸਰ ਲੈ ਕੇ ਸ਼ਿਫਟ ਹੋ ਰਹੀ ਸੀ ਅਤੇ ਮੈਂ ਇਹ ਸੋਚ ਰਹੀ ਸੀ ਮੈਂ ਆਪਣੇ ਬੇਟੇ ਨੂੰ ਯਾਰ ਮੁਕਤਸਰ ਦੇ ਨਾ ਕਿਸੇ ਬੈਸਟ ਸਕੂਲ ਵਿੱਚ ਪਾਉਣਾ ਹੈਗਾ ਵੀ ਕੋਈ ਵਧੀਆ ਸਕੂਲ ਹੋਵੇ ਤਾਂ ਤੁਸੀਂ ਦੱਸ ਸਕਦੇ ਹੋ ਮੈਨੂੰ ਕੋਈ ਵਧੀਆ ਜਿਹਾ ਸਕੂਲ ਅੱਛਾ ਅੱਛਾ ਹਾਂ ਅੱਛਾ ਅੱਛਾ ਯਾਰ ਮੈਂ ਸੋਚਿਆ ਸੀ ਉੱਥੇ ਦਸ਼ਮੇਸ਼ ਕਾਲਜ ਆ ਨਾ ਜਿਹੜਾ ਮੁਕਤਸਰ ਸਾਹਿਬ ਮੈਂ ਸੁਣਿਆ ਵੀ ਉੱਥੇ ਬਹੁਤ ਸਾਰੀ ਬੱਚਿਆਂ ਨੂੰ ਫੈਸਿਲਿਟੀ ਦਿੱਤੀਆਂ ਜਾਂਦੀਆਂ ਜਿਵੇਂ ਖੇਡਣ ਨੂੰ ਪਲੇਗਰਾਉਂਡ ਹੈਗਾ ਠੀਕ ਹੈ ਸਿੰਗਿੰਗ ਲਈ ਬਹੁਤ ਸਾਰੇ ਇੰਨਸਟਰੂਮੈਂਟਸ ਹੈਗੇ ਹੈ ਹੋਰ ਵੀ ਬਹੁਤ ਸਾਰੀਆਂ ਮਤਲਬ ਐਜੂਕੇਸ਼ਨਸ ਟਿਪਸ ਦਿੱਤੀਆਂ ਜਾਂਦੀਆਂ ਹੈਗੀਆਂ ਅਤੇ ਮੈਂ ਤਾਂ ਆਰਿਅਨ ਨੂੰ ਉੱਥੇ ਹੀ ਪਾਉਣਾ ਚਾਹੁੰਦੀ ਸੀਗੀ ਗੀ ਅੱਛਾ ਅੱਛਾ ਅੱਛਾ ਅਤੇ ਮੇਰੇ ਬੇਟੇ ਨੂੰ ਤਾਂ ਯਾਰ ਸਵੀਮਿੰਗ ਬਹੁਤ ਪਸੰਦ ਹੈਗੀ ਆ ਮੈਂ ਹੁਣ ਇਹ ਜ਼ਿੱਦ ਕਰ ਰਿਹਾ ਕਿ ਮਮਾ ਮੈਂ ਨਾ ਸਵੀਮਿੰਗ ਕੰਪਟੀਸ਼ਨ ਵਾਸਤੇ ਪਾਰਟੀਸੀਪੇਟ ਕਰਨਾ ਹੈਗਾ ਤਾਂ ਮੈਂ ਮਤਲਬ ਇਹੋ ਜਿਹੇ ਸਕੂਲ 'ਚ ਪਾ ਦਿਓ ਮੈਨੂੰ ਵੀ ਮੈਂ ਦ ਫਸਟ ਪੁਜੀਸ਼ਨ ਹਾਸਿਲ ਕਰਾਂ ਅੱਛਾ ਤੇ ਹਾਂ ਚਲੋ ਮੈਂ ਹਾਂ ਚਲੋ ਮੈਂ ਨਰੇਸ਼ ਨਾਲ ਗੱਲ ਕਰਕੇ ਪੁੱਛੂਗੀ ਵੀ ਕਿਹੜਾ ਸਕੂਲ ਬੈਟਰ ਹੈਗਾ ਜਾਂ ਕਿਹੜਾ ਨਹੀਂ ਹੈ ਫਿਰ ਅਸੀਂ ਗੇੜਾ ਮਾਰ ਕੇ ਜਾਵਾਂਗੇ ਅਤੇ ਦੇਖਾਂਗੇ ਫਿਰ ਵੀ ਕਿਸ ਤਰ੍ਹਾਂ ਦਾ ਸਕੂਲ ਹੈਗਾ ਕਿਸ ਤਰ੍ਹਾਂ ਦਾ ਨਹੀਂ ਜੇਕਰ ਤੁਸੀਂ ਚੱਲ ਸਕਦੇ ਹੋ ਫੀਸ ਰਿਗਾਰਡਿੰਗ ਡਿਟੇਲ ਮੈਂ ਇੰਟਰਨੈਟ 'ਤੇ ਦੇਖੀਆਂ ਸੀਗੀਆਂ ਹੈਗੀਆਂ ਅਤੇ ਇੱਕ ਬੱਚੇ ਦੇ ਨਾਂ ਇੱਕ ਬੱਚੇ ਦੇ ਨਾਮ ਦੇ ਨਾਲ ਜੇ ਮਤਲਬ ਆਪਾਂ ਮੰਨ ਲਓ ਤੁਹਾਡਾ ਬੇਟਾ ਜਾਂਦਾ ਹੈਗਾ ਨਵੀ ਜਾਂਦਾ ਹੈਗਾ ਨਵੀ ਦੀ ਐਡਮੀਸ਼ਨ ਕਰਵਾਉਂਦੇ ਹਾਂ ਤਾਂ ਆਪਾਂ ਨੂੰ ਵੀਹ ਪ੍ਰਸੈਂਟ ਫੀਸ ਰਿਟਰਨ ਮਿਲਦੀ ਹੈ ਅਤੇ ਨਾਲ ਸਕਾਲਰਸ਼ਿਪ ਵੀ ਮਿਲਦੀ ਹੈ ਹਾਂ ਹਾਂ ਨਹੀਂ ਵਧੀਆ ਵੀ ਹੈ ਅਤੇ ਬਹੁਤ ਸਾਰਾ ਕੁਛ ਸਿੱਖਣ ਨੂੰ ਵੀ ਮਿਲਦਾ ਮੈਂਕਸ ਦੀਆਂ ਵੀ ਬਹੁਤ ਜ਼ਿਆਦਾ ਫਸਿਲਟੀਜ਼ ਹੈ ਹਾਂ ਅਤੇ ਚਲੋ ਮੈਂ ਇਹ ਹੀ ਤੁਹਾਡੇ ਨਾਲ ਗੱਲ ਕਰਨੀ ਸੀ ਕਿ ਆਪਾਂ ਗੱਲ ਕਰਾਂਗੇ ਆਰਿਅਨ ਬਾਰੇ ਨਵੀ ਬਾਰੇ ਠੀਕ ਹੈ ਓਕੇ ਚਲੋ ਠੀਕ ਹੈ ਮਿਲਦੇ ਹਾਂ